ਅਠਾਈ ਸਤੰਬਰ ਉੱਨੀ ਸੌ ਛਿਆਹਠ ਵੀਹ ਅਗਸਤ ਉੱਨੀ ਸੌ ਸੱਤਰ ਸਤਾਰ੍ਹਾਂ ਜੁਲਾਈ ਉੱਨੀ ਸੌ ਤ੍ਰਿਆਨਵੇਂ ਅੱਠ ਮਾਰਚ ਉੱਨੀ ਸੌ ਅਠਾਨਵੇਂ ਚੌਦ੍ਹਾਂ ਅਪ੍ਰੈਲ ਦੋ ਹਜ਼ਾਰ ਬਾਈ